ਨਮਸਕਾਰ ਜੀ ਮੇਰਾ ਨਾਮ ਪੂਜਾ ਦੇਵੀ ਹੈ ਅਤੇ ਮੈਂ ਪਠਾਨਕੋਟ ਦੀ ਰਹਿਨ ਰਹਿਣ ਵਾਲੀ ਹਾਂ ਮੈਂ ਅੱਜ ਯੋਗਾ ਬਾਰੇ ਕੁਛ ਦੱਸਣਾ ਚਾਹੁੰਦੀ ਹਾਂ ਅਤੇ ਮੈਨੂੰ ਮੈਂ ਸਵੇਰੇ ਰੋਜ਼ ਚਾਰ ਵਜੇ ਉੱਠ ਕੇ ਯੋਗਾ ਕਰਦੀ ਹਾਂ ਅਤੇ ਸ਼ਾਮ ਨੂੰ ਵੀ ਕਰਦੀ ਹਾਂ ਕਿਉਂਕਿ ਮੇਰਾ ਵੇਟ ਬਹੁਤ ਵੱਧ ਰਿਹਾ ਸੀ ਇਸ ਕਰਕੇ ਮੇਰੇ ਮਾਤਾ ਜੀ ਮੈਨੂੰ ਰੋਜ਼ ਯੋਗਾ ਕਰਨ ਲਈ ਕਹਿੰਦੇ ਸਨ ਕਿਉਂਕਿ ਮੇਰੇ ਮਾਤਾ ਜੀ ਵੀ ਯੋਗਾ ਕਰਦੇ ਸ ਹਨ ਯੋਗਾ ਕਰਨ ਨਾਲ ਮੈਨੂੰ ਬਹੁਤ ਹੀ ਫਾਇਦੇ ਹੋਏ ਘਰਦਿਆਂ ਤੋਂ ਇਲਾਵਾ ਮੈਂ ਬਾਬਾ ਰਾਮਦੇਵ ਜੀ ਦੇ ਜੀ ਦੇ ਚੈਨਲ ਯੋਗਾ ਯੋਗਾ ਦੀ ਯੋਗਾ ਵੀ ਸਿੱਖਿਆ ਸਿੱਖਿਆ ਯੋਗਾ ਦੇ ਆਸਣ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦੇ ਰਹਿੰਦਾ ਹੈ ਅਤੇ ਅਸੀਂ ਹਮੇਸ਼ਾ ਖੁਸ਼ਹਾਲ ਜ਼ਿੰਦਗੀ ਜਿਉਂਦੇ ਹਾਂ ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਯੋਗਾ ਸਾਡੀ ਜ਼ਿੰਦਗੀ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਅਤੇ ਸਾਨੂੰ ਸਾਰਿਆਂ ਨੂੰ ਸਵੇਰੇ ਰੋਜ਼ ਜਲਦੀ ਉੱਠ ਕੇ ਯੋਗਾ ਕਰਨਾ ਚਾਹੀਦਾ ਹੈ ਧੰਨਵਾਦ ਜੀ